ਹਾਂਜੀ ਹਾਲ ਹੀ ਦੇ ਵਿੱਚ ਤਾਂ ਪਟਿਆਲੇ ਮੈਂ ਸ਼ਹਿਰ 'ਚ ਹੀ ਬੈਠਾ ਹੀ ਹਾਂ ਇਸ ਟਾਇਮ ਖਾਲਸਾ ਕੋਲਜ ਪਟਿਆਲਾ ਵਿਖੇ ਮੈਂ ਸਹਾਇਕ ਪ੍ਰੋਫੈਸਰ ਦੀ ਸੇਵਾ ਨਿਭਾਅ ਰਿਹਾ ਅਤੇ ਠੰਢ ਜਿਹੜੀ ਆ ਬਹੁਤ ਜ਼ਿਆਦਾ ਔਰ ਮੌਸਮ ਵਿਭਾਗ ਦੇ ਦਿੱਤੇ ਹੋਏ ਅੰਕੜਿਆਂ ਦੇ ਮੁਤਾਬਕ ਇਹਨਾਂ ਦਿਨਾਂ ਦੇ ਵਿੱਚ ਸਪੈਸੀਫਿਕ ਇਹਨਾਂ ਦਿਨਾਂ 'ਚ ਵਿਸ਼ੇਸ਼ ਤੌਰ 'ਤੇ ਜਿਹੜੀ ਠੰਢ ਪਈ ਹੈ ਇਹ ਪੰਜਾਹ ਸਾਲਾਂ ਤੋਂ ਪੰਜਾਹ ਸਾਲਾਂ ਬਾਅਦ ਪਈ ਹੈ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਅਤੇ ਕਠੋਰ ਗਰਮੀਆਂ ਦਾ ਵੀ ਜਦੋਂ ਜੂਨ ਜੁਲਾਈ ਦਾ ਮਹੀਨਾ ਹੁੰਦਾ ਆ ਜੁਲਾਈ ਅਗਸਤ ਦੇ ਵਿੱਚ ਹੁੰਮਸ ਬਹੁਤ ਹੁੰਦੀ ਹੈ ਸਰਦੀਆਂ ਦਾ ਅਨੁਭਵ ਮੈਂ ਤੁਹਾਨੂੰ ਹੁਣ ਦੱਸ ਹੀ ਰਿਹਾ ਜਿਵੇਂ ਮੈਂ ਅਸੀਂ ਕਰ ਰਹੇ ਹਾਂ ਅਤੇ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਹੈਗੀ ਆ ਉਹ ਇਸ ਵਾਰ ਜਿਹੜੀ ਦੇਖੀ ਹੈ ਜਿਵੇਂ ਮੈਂ ਦੱਸਿਆ ਕਿ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਿਕ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਪੰਜਾਹ ਸਾਲਾਂ ਬਾਅਦ ਜਿਹੜੀ ਆ ਉਹ ਮਤਲਬ ਇੰਨੀ ਗਰਮੀ ਪਈ ਆ ਸੋਕੇ ਦਾ ਪ੍ਰਭਾਵ ਨਹੀਂ ਸਾਡੇ ਇੱਥੇ ਕਿਉਂਕਿ ਸਾਡੇ ਸਿੰਜਾਈ ਦੇ ਸਾਧਨ ਅੱਛੇ ਹੈਗੇ ਆ ਹੜ੍ਹਾਂ ਦੀ ਸੋਰੀ ਨਹਿਰੀ ਪਾਣੀ ਦੀ ਵਿਵਸਥਾ ਹੈਗੀ ਆ ਟਿਊਬਵੈੱਲ ਹੈਗੇ ਨੇ ਹੜ੍ਹਾਂ ਦੀ ਸਮੱਸਿਆ ਅਸੀਂ ਹਾਲ ਹੀ ਦੇ ਵਿੱਚ ਹੀ ਪਿਛਲੇ ਮਤਲਬ ਤਕਰੀਬਨ ਆਹਾ ਜੁਲਾਈ ਅਗ ਜੂਨ ਜੁਲਾਈ ਅਗਸਤ ਦੇ ਵਿੱਚ ਇੱਥੇ ਪਾਣੀ ਆ ਗਿਆ ਸੀਗਾ ਬਹੁਤ ਜ਼ਿਆਦਾ ਫਸਲਾਂ ਬਰਬਾਦ ਹੋਗੀਆਂ ਸੀਗੀਆਂ ਪਰ ਦੁਬਾਰਾ ਤੋਂ ਲੋਕਾਂ ਨੇ ਬੀਜ ਲਈਆਂ ਸਟੇਬਲ ਹੋ ਗਏ ਸੀਗੇ ਅਤੇ ਹਾਲ ਹੀ ਦੇ ਵਿੱਚ ਹੜ੍ਹਾਂ ਦਾ ਜੀ ਜਿਹੜਾ ਹੈਗਾ ਉਹ ਅਸੀਂ ਅਨੁਭਵ ਕਰਕੇ ਹਟੇ ਹਾਂ ਥੈਂਕ ਯੂ